ਅੱਜ ਕੱਲ੍ਹ ਅਸੀਂ ਕਾਫ਼ੀ ਵਹਿਮ ਭਰਮ ਦੇਖਣ ਨੂੰ ਸਾਨੂੰ ਮਿਲਦੇ ਹਨ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਈ ਪੇਂਸ਼ਟ ਇਹ ਹੁੰਦੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਮੇਰੇ ਸਰੀਰ 'ਤੇ ਕੀੜੀਆਂ ਤੁਰਦੀਆਂ ਪਈਆਂ ਹੈ ਉਨ੍ਹਾਂ ਨੂੰ ਅਵਾਜ਼ਾਂ ਆ ਰਹੀਆਂ ਹੁੰਦੀਆਂ ਇਵੇਂ ਲੱਗਦਾ ਕਿ ਮੈਨੂੰ ਕੋਈ ਬੁਲਾ ਰਿਹਾ ਜਾਂ ਮੈਨੂੰ ਕੁਛ ਸੁਣ ਰਿਹਾ ਬਟ ਇਹੋ ਜਿਹਾ ਕੁਛ ਹੁੰਦਾ ਨਹੀਂ ਦੀਵਾਰ 'ਤੇ ਤਸਵੀਰ ਲੱਗੀ ਨਹੀਂ ਹੁੰਦੀ ਬਟ ਉਹਨਾਂ ਨੂੰ ਲੱਗਦਾ ਹੈਗਾ ਕਿ ਤਸਵੀਰ ਲੱਗੀ ਹੋਈ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਇੱਕ ਕਿਸੀ ਨੇ ਉਹਦੇ 'ਤੇ ਜਾਦੂ ਟੂਣਾ ਕਰ ਦਿੱਤਾ ਬਟ ਇਹੋ ਜਿਹਾ ਕੁਛ ਨਹੀਂ ਹੁੰਦਾ ਹੈਗਾ ਇਹ ਇੱਕ ਬਿਮਾਰੀ ਹੁੰਦੀ ਹੈ ਦਿਮਾਗੀ ਬਿਮਾਰੀ ਹੁੰਦੀ ਹੈ ਜਿਹਨੂੰ ਅਸੀਂ ਸਾਈਕੋਸਿਸ ਕਹਿੰਦੇ ਹਾਂ ਲੋਕ ਡਾਕਟਰ ਕੋਲ ਨਾ ਲਿਜਾ ਕੇ ਇਹਨਾਂ ਨੂੰ ਤਾਂਤਰਿਕਾਂ ਕੋਲ ਜਾਂ ਪੰਡਤਾਂ ਕੋਲ ਲੈ ਜਾਂਦੇ ਹਨ ਜਦ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਲੋਕਾਂ ਨੂੰ ਡਾਕਟਰ ਬਾਰੇ ਪਤਾ ਲੱਗਦਾ ਹੈ ਕਿ ਹਾਂਜੀ ਇੱਥੇ ਉਹਦਾ ਇਲਾਜ ਹੈਗਾ